ਧਰਮ ਦੀਆਂ ਸਿੱਖਿਆਵਾਂ ਤੋਂ ਅਸੀਂ ਅਨੈਤਿਕ ਕਦਰਾਂ ਕੀਮਤਾਂ ਸਿੱਖਦੇ ਹਾਂ ਅਤੇ ਜਿਹੜੀਆਂ ਕਿ ਸਾਡੇ ਜੀਵਨ ਦੇ ਵਿੱਚ ਸਹੀ ਢੰਗ ਨਾਲ ਚੱਲਣ ਲਈ ਸਾਡੇ ਲਈ ਬਹੁਤ ਜ਼ਰੂਰੀ ਹੁੰਦੀਆਂ ਆ ਸੋ ਅਸੀਂ ਜੇ ਧਰਮ ਧਾਰਮਿਕ ਦੇ ਹਿਸਾਬ ਨਾਲ ਚੱਲਦੇ ਹਾਂ ਤਾਂ ਅਸੀਂ ਇੱਕ ਸੰਜਮ 'ਚ ਜਾਂ ਉਹਦੇ ਰਹਿਣਾ ਸਿੱਖ ਜਾਂਦੇ ਹਾਂ ਜੋ ਕਿ ਬਹੁਤ ਜ਼ਰੂਰੀ ਹੈ ਸਾਡੀ ਜ਼ਿੰਦਗੀ ਵਧੀਆ ਜ਼ਿੰਦਗੀ ਜਿਉਣ ਦੇ ਲਈ ਸੋ ਆਈ ਥਿੰਕ ਮਤਲਬ ਇਹ ਚੀਜ਼ਾਂ ਨ ਧਰਮ ਦੇ ਅਕੋਡਿੰਗ ਸਿੱਖਿਆਵਾਂ ਦੇ ਹਿਸਾਬ ਨਾਲ ਜ਼ਿੰਦਗੀ ਨੂੰ ਜਿਉਣਾ ਜ਼ਿੰਦਗੀ ਜੀਵਨ ਜਿਉਣ ਦੀ ਜਾਚ ਸਿੱਖਣੀ ਬਹੁਤ ਵਧੀਆ ਹੈ ਗੱਲ ਹੈਗੀ ਆ ਸੋ ਮੈਂ ਇਹਨਾਂ ਦੇ ਵਿੱਚ ਬਹੁਤ ਵਿਸ਼ਵਾਸ ਕਰਦੀ ਹਾਂ